ਹੈਲੋ ਹਾਂਜੀ ਮੈਂ ਨਾ ਇੱਕ ਕੈਬ ਬੁੱਕ ਕਰਨੀ ਸੀ ਅਤੇ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੇ ਕੋਲ ਕੀ ਕੀ ਉਪਲਬਧ ਹੈ ਆਟੋ ਹੈ ਅਤੇ ਆਟੋ ਜਾਂ ਉਹ ਕੈਬ ਕੈਬ ਬੁੱਕ ਕਰ ਦਿਉ ਤੁਸੀਂ ਅਸੀਂ ਮੈਂ ਸੈਂਡ ਕਰ ਰਹੀ ਤੁਹਾਨੂੰ ਐਡਰੈੱਸ ਅਤੇ ਨਜ਼ਰ ਸੁਹਾਨਵੀ ਚੌਂਕ 'ਤੇ ਆ ਕੇ ਪਿੱਕ ਕਰ ਲਉ ਮੈਂ ਸਤਾਰਾਂ ਦੀ ਮਾਰਕੀਟ ਜਾਣਾ